ਮੈਂ ਪੰਜਾਬੀ ਗੀਤ ਸੁਣਨਾ ਬਹੁਤ ਪਸੰਦ ਕਰਦੀ ਹਾਂ ਬਾਕੀ ਪੰਜਾਬੀ ਵੀ ਸੁਣ ਲੈਂਦੀ ਹਾਂ ਤੇ ਹਿੰਦੀ ਵੀ ਬਾਕੀ ਜਿਆਦਾ ਪੰਜਾਬੀ ਸੁਣ ਕੇ ਜ਼ਿਆਦਾ ਖੁਸ਼ ਹੁੰਦੀ ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਆਂ ਤੇ ਇਸ ਕਰਕੇ ਅਸੀਂ ਪੰਜਾਬੀ ਗੀਤ ਨੂੰ ਅੱਛੀ ਤਰ੍ਹਾਂ ਨਾਲ ਸਮਝਦੇ ਹਾਂ ਤੇ ਗਾਂਦੇ ਹਾਂ ਪੰਜਾਬੀ ਗੀਤ ਇੱਕ ਐਦਾਂ ਦੇ ਗੀਤ ਹੈ ਕਿ ਜਿਹੜੇ ਪੰਜਾਬੀ ਪਿਚਰਾਂ ਦੇਖਣ ਦਾ ਸ਼ੌਂਕ ਪੰਜਾਬੀ ਗੀਤਾ ਸੁਣਨ ਦਾ ਸ਼ੌਂਕ ਤੇ ਮੈਂ ਉਹਨਾਂ ਨੂੰ ਆਪਣੇ ਫੋਨ ਦੇ ਵਿੱਚ ਟੀ ਵੀ ਵਿੱਚ ਜਾਂ ਲੈਪਟੋਪ ਵਿੱਚ ਜਾਂ ਬੱਚਿਆਂ ਦੇ ਨਾਲ ਜਾਂ ਕਿਤੇ ਵਿਆਹ ਸ਼ਾਦੀ ਦੇ ਜਾਨੀ ਆ ਉੱਥੇ ਵੀ ਜਾਂ ਅਸੀਂ ਕਦੀ ਕਿਤੇ ਆਪਣੇ ਕੋਈ ਫੰਕਸ਼ਨ ਤੇ ਜਾਨੇ ਤਾਂ ਅਸੀਂ ਕਹਿੰਦੇ ਐਹ ਵਾਲਾ ਗਾਣਾ ਲਗਾਓ ਪੰਜਾਬੀ ਦੇ ਮੈਂ ਇਸਦੇ ਤੇ ਡਾਂਸ ਕਰਾਂਗੀ ਤੇ ਇਹ ਮੈਨੂੰ ਗਾਣਾ ਬਹੁਤ ਅੱਛਾ ਲੱਗਦਾ ਹੈ ਐਦਾਂ ਦੇ ਗਾਣੇ ਮੈਨੂੰ ਪਸੰਦ ਆਂਦੇ ਹਨ ਤੇ ਬਾਕੀ ਤੇ ਮੈਂ ਜਿਆਦਾ ਨੱਚਣ ਟੱਪਣ ਵਾਲੇ ਤੇ ਰੱਬ ਦੇ ਨਾਂ ਦੇ ਨਾਲ ਜੁੜਨ ਵਾਲੇ ਗਾਣੇ ਸੁਣਨਾ ਜਿਆਦਾ ਪਸੰਦ ਕਰਦੀ ਹਾਂ ਤੇ ਅੱਜਕੱਲ ਗਾਣੇ ਬਹੁਤ ਵਧੀਆ ਆਂਉਂਦੇ ਹਨ ਜਿਨਾਂ ਦਾ ਨਾਲ ਰੱਬ ਦੇ ਨਾਲ ਵੀ ਜੁੜਿਆ ਹੁੰਦਾ ਕਿ ਕੱਲੇ ਗਾਣੇ ਤੁਸੀਂ ਆਪਣੇ ਸਿਰਫ ਨੱਚਣ ਟੱਪਣ ਲਈ ਨਹੀਂ ਤੁਸੀਂ ਉਹਨਾਂ ਨੂੰ ਰੱਬ ਦੇ ਨਾਲ ਵੀ ਜੋੜ ਸਕਦੇ ਹੋ ਅੱਜ ਕੱਲ ਬਹੁਤ ਅੱਛੇ ਗਾਣੇ ਆਉਂਦੇ ਹਨ ਤੇ ਗਾਣੇ ਸੁਣਨਾ ਇੱਕ ਦਿਲ ਨੂੰ ਵੀ ਖੁਸ਼ ਕਰਦਾ ਹੈ ਤੁਹਾਡੀ ਮਨ ਤੁਹਾਡਾ ਤਰੋ ਤਾਜਾ ਹੁੰਦਾ ਹੈ ਤੁਹਾਡੀ ਤਬੀਅਤ ਠੀਕ ਹੁੰਦੀ ਹੈ ਤੁਸੀਂ ਇੱਕ ਮਾਹੌਲ ਚੋਂ ਬਾਹਰ ਆਉਂਦੇ ਹੋ ਤੁਸੀਂ ਗਾਨੇ ਸੁਣਨਾ ਪਸੰਦ ਕਰਦੇ ਹੋ ਤੇ ਤੁਸੀਂ ਉਹਦੇ ਨਾਲ ਠੀਕ ਮਹਿਸੂਸ ਕਰਦੇ ਹੋ ਤੇ ਉਹਦੇ ਨਾਲ ਤੁਹਾਡਾ ਇੱਕ ਕੰਮ ਕਰਦੇ ਹੋਏ ਘਾਟ ਚ ਵੀ ਤੁਹਾਨੂੰ ਅੱਛਾ ਲੱਗਦਾ ਹੈ ਧੰਨਵਾਦ